ਖੇਡਾਂ ਪੇਂਡੂ ਖੇਡਾਂ ਖੇਡਣ ਨਾਲ ਪੇਂਡੂ ਖੇਤਰ ਦੇ ਲੋਕਾਂ ਨੂੰ ਬਹੁਤ ਲਾਭ ਹੁੰਦਾ ਜਿਵੇਂ ਕਬੱਡੀ ਦੇ ਵਿੱਚ ਲਾ ਲਓ ਹੈ ਨਾ ਕਬੱਡੀ ਦੇ ਵਿੱਚ ਪਿਆਰ ਮੁਹੱਬਤ ਬਣਿਆ ਰਹਿੰਦਾ ਲੋਕਾਂ ਦਾ ਆਪਸ ਵਿੱਚ ਆਪਸ 'ਚ ਗੱਲਬਾਤ ਹੁੰਦੀ ਆ ਉਹਨਾਂ ਦੀ ਹੈ ਨਾ ਕਿਵੇਂ ਖੇਡਣਾ ਖੇਡਣਾ ਜਾਂ ਆਪਸ ਵਿੱਚ ਖੇਡਾਂ ਖੇਡਣ ਆਉਂਦੇ ਆ ਪੇਂਡੂ ਮੈਦਾਨਾਂ ਦੇ ਵਿੱਚ ਤਾਂ ਵਧੀਆ ਲੋਕ ਮਿਲ ਜੁਲ ਕੇ ਖੇਡਦੇ ਆ ਹੋਰ ਵਧੀਆ ਖੇਡਾਂ ਖੇਡਦੇ ਉੱਥੇ ਜਿਵੇਂ ਵਾਲੀਬਾਲ ਲਾ ਲਓ ਅਤੇ ਖੇਡਾਂ ਖੇਡਦੇ ਖੇਡਦੇ ਹੋਰ ਬਹੁਤ ਗੱਲਾਂ ਬਾਤਾਂ ਕਰਦੇ ਆ ਸਮਾਜ ਦੀਆਂ ਗੱਲਾਂ ਕਰਦੇ ਆ ਖੇਤੀਬਾੜੀ ਦੀਆਂ ਗੱਲਾਂ ਕਰਦੇ ਆ ਉਹ ਆਪਸ ਦੇ ਵਿੱਚ ਮਿਲ ਜੁਲ ਕੇ ਰਹਿੰਦੇ ਆ ਪਿੰਡਾਂ ਦੇ ਲੋਕ ਅਤੇ ਜਿਵੇਂ ਬਜ਼ੁਰਗ ਲਾ ਲਓ ਸੱਥਾਂ ਦੇ ਵਿੱਚ ਬੈਠ ਕੇ ਉਹ ਬਜ਼ੁਰਗ ਗੱਲਾਂ ਕਰਦੇ ਆ ਪਿੰਡਾਂ ਦੇ ਮੈਦਾਨਾਂ ਦੀਆਂ ਵੀ ਬੱਚੇ ਖੇਡਦੇ ਆ ਵਧੀਆ ਨਸ਼ੇ ਤੋਂ ਦੂਰ ਨੇ ਅਤੇ ਹੋਰ ਬਜ਼ੁਰਗ ਗੱਲਾਂ ਕਰਦੇ ਆ ਕਿ ਵੀ ਸਮਾਜ ਦੇ ਪ੍ਰਤੀ ਗੱਲਾਂ ਕਰਦੇ ਨੇ ਵੀ ਕੀ ਸਮਾਜ ਦੇ ਵਿੱਚ ਕੀ ਚੱਲ ਰਿਹਾ ਰਾਜਨੀਤੀ ਦੇ ਵਿੱਚ ਕੀ ਚੱਲ ਰਿਹਾ ਹੈ ਇਹ ਸਭ ਗੱਲਾਂ ਇੱਥੇ ਆਪਣੇ ਖੇਡਾਂ ਖੇਡਣ ਨਾਲ ਕਿ ਪੇਂਡੂ ਖੇਤਰ ਦੇ ਵਿੱਚ ਹੁੰਦੀਆਂ ਜਿਵੇਂ ਖੇਡ ਮੈਦਾਨਾਂ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਖਿਡਾਰੀ ਹੋਰ ਸਾਰੇ ਬਜ਼ੁਰਗ ਜਿਹੜੇ ਦੇਖਣ ਆਉਂਦੇ ਆ ਗਰਾਊਂਡਾਂ ਦੇ ਵਿੱਚ ਖੇਡਾਂ ਕਬੱਡੀ ਦੇਖਣ ਆਉਂਦੇ ਆ ਫਿਰ ਉਹ ਆਪਸ ਦੇ ਵਿੱਚ ਇਹ ਲੋਕ ਗੱਲਾਂ ਬਾਤਾਂ ਕਰਦੇ ਆ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਆ